ਹੈਲੋ ਸਤਿ ਸ਼੍ਰੀ ਅਕਾਲ ਜੀ ਮੈਨੂੰ ਪੰਜਾਬ ਦੇ ਢਾਬਿਆਂ ਬਾਰੇ ਖਾਣੇ ਬਾਣਿਆਂ ਬਾਰੇ ਵਧੀਆ ਜੀ ਜਾਣਕਾਰੀ ਦਿਓ ਰੈਸਟੋਰੈਂਟਾ ਦੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਮੈਂ ਤੁਹਾਨੂੰ ਦਫ਼ਤਰ ਵਿੱਚ ਆ ਕੇ ਜੀ ਮਿਲਦੀ ਹਾਂ ਗੱਲ ਕਰੂੰਗੇ ਠੀਕ ਆ ਜੀ